ਮੀਡੀਆ ਦੇ ਵਿੱਚ ਸਾਡੇ ਬਹੁਤ ਸਾਰੇ ਚੈਨਲ ਪੰਜਾਬੀ ਟੀ ਵੀ 'ਤੇ ਖਬਰ ਆਉਂਦੀਆਂ ਹਨ ਪੰਜਾਬੀ ਗਾਣੇ ਨਿਊਜ਼ ਸਾਰਾ ਕੁਛ ਆਉਂਦਾ ਹੈ ਪੰਜਾਬੀ ਅਖ਼ਬਾਰਾਂ ਅਜੀਤ ਅਖ਼ਬਾਰ ਹੋ ਗਈ ਜੋ ਕਿ ਘਰ ਘਰ ਪਹੁੰਚਾਈ ਜਾਂਦੀ ਹੈ ਲੋਕਾਂ ਨੂੰ ਉਹਦੇ ਵਿੱਚ ਦੇਖ ਕੇ ਪਤਾ ਲੱਗਦਾ ਵੀ ਐਥੇ ਅੱਜ ਕੀ ਹੋਇਆ ਇੱਥੇ ਕੀ ਹੋਇਆ ਪੰਜਾਬੀ ਵਿੱਚ ਸਾਰਾ ਕੁਛ ਸਾਨੂੰ ਪਤਾ ਲੱਗਦਾ ਅਤੇ ਪੰਜਾਬੀ ਸਾਡੀ ਬਹੁਤ ਹੀ ਵਧੀਆ ਭਾਸ਼ਾ ਹੈ ਪੰਜਾਬੀ ਵਿੱਚ ਸਾਨੂੰ ਹਰ ਇੱਕ ਬੱਚੇ ਤੋਂ ਲੈ ਕੇ ਬੜੇ ਤੱਕ ਪੰਜਾਬੀ ਬੋਲਦੇ ਹਨ ਬਹੁਤ ਹੀ ਵਧੀਆ ਭਾਸ਼ਾ ਪੰਜਾਬੀ ਮੀਡੀਆ ਲਾਈਵ ਚੈਨਲ ਉਹ ਪੰਜਾਬੀ ਗਾਣੇ ਆਣੇ ਉਹ ਪੰਜਾਬੀ ਸਾਰਾ ਕੁਛ ਪੰਜਾਬੀ ਦੇ ਵਿੱਚ ਹੈ ਪੰਜਾਬੀ ਇੱਕ ਇਹੋ ਜਿਹੀ ਭਾਸ਼ਾ ਹੈ ਦੂਰ ਦੂਰ ਤੱਕ ਲੋਕੀ ਬੈਠੇ ਪੰਜਾਬੀ ਸੁਣਦੇ ਬੋਲਦੇ ਹਨ ਇਹਚ ਪੰਜਾਬੀ ਬੋਲਣ ਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਹਨ ਸਾਰਿਆਂ ਨੂੰ ਪੰਜਾਬੀ ਸਮਝ ਲੱਗਦੀ ਹੈ ਬਹੁਤ ਹੀ ਵਧੀਆ ਪੰਜਾਬੀ ਲਾਈਵ ਆਉਂਦੇ ਆ ਕਬੱਡੀ ਲਾਈਵ ਹੋ ਗਿਆ ਉਹ ਪੰਜਾਬੀ ਕਿਸੇ ਦੀ ਡੈਥ ਹੋ ਗਈ ਉਹਦੇ ਪਰ ਲਾਈਵ ਕਿਸੇ ਦੀ ਖੁਸ਼ੀ ਗਮੀ ਉਸਦਾ ਲਾਈਵ ਹਰ ਇੱਕ ਚੀਜ਼ ਲਾਈਵ ਆਪਣੇ ਪੰਜਾਬੀ ਹੀ ਬੋਲਦੇ ਹਨ